ਅਸੀਂ ਆਪਣੇ ਜਾਨਵਰਾਂ ਦੀ ਦੇਖਭਾਲ ਖੁਦ ਹੀ ਕਰਦੇ ਹਾਂ ਉਸ ਦੀ ਦੇਖਭਾਲ ਕਰਨ ਵਾਸਤੇ ਕੋਈ ਬਾਹਰੀ ਬੰਦਾ ਨਹੀਂ ਰੱਖਿਆ ਔਰ ਉਹਨਾਂ ਦੇ ਹਾਈਜੀਨਿਕ ਵਾਸਤੇ ਅਸੀਂ ਉਹਨਾਂ ਦਾ ਉਹਨਾਂ ਦੀ ਸਫਾਈ ਨੇੜੇ ਉਹਨਾਂ ਦੇ ਬਹੁਤ ਸਫਾਈ ਰੱਖਦੇ ਹਾਂ ਤਾਂ ਜੋ ਮੱਖੀ ਮੱਛਰ ਉਹਨਾਂ ਨੂੰ ਤੰਗ ਨਾ ਕਰੇ ਅਤੇ ਉਹਨਾਂ ਦੇ ਖਾਣ ਪੀਣ ਵਾਸਤੇ ਟਾਈਮ ਨਾਲ ਪੱਠੇ ਪਾਉਣੇ ਪਾਣੀ ਪਿਲਾਉਣਾ ਅਤੇ ਉਹਨਾਂ ਨੂੰ ਥੋੜ੍ਹੀ ਦੇਰ ਵਾਸਤੇ ਖੁੱਲ੍ਹੇ ਛੱਡ ਕੇ ਉਹਨਾਂ ਦੇ ਮਾਹੌਲ ਨੂੰ ਚੇਂਜ ਕਰਨਾ ਇਹ ਸਭ ਅਸੀਂ ਖੁਦ ਹੀ ਕਰਦੇ ਹਾਂ ਧੰਨਵਾਦ